ਮੇਰੇ ਦਾਦਾ ਜੀ ਨੇ ਸਾਨੂੰ ਮਹਾਨ ਆਗੂ ਗਦਰੀ ਬਾਬੇ ਬਾਰੇ ਦੱਸਿਆ ਸੀਗਾ ਉਹ ਕਹਿੰਦੇ ਹੈ ਨਾ ਵੀ ਗਦਰੀ ਬਾਬੇ ਸੀਗੇ ਨਾ ਵੀ ਉਹ ਉਹਨਾਂ ਨੇ ਇੰਨੀ ਵਧੀਆ ਮਤਲਬ ਕਿ ਹੈ ਨਾ ਉਹਨਾਂ ਨੇ ਉਸ ਟਾਈਮ 'ਤੇ ਨਾ ਮਤਲਬ ਇਹ ਉੱਨੀ ਸੌ ਚੌਦਾਂ ਦੀ ਗੱਲ ਹੈਗੀ ਅਤੇ ਉਦੋਂ ਮਤਲਬ ਕਿ ਉਹਨਾਂ ਨੇ ਇੰਨੀ ਵਧੀਆ ਅਗਵਾਈ ਕੀਤੀ ਸੀਗੀ ਮਤਲਬ ਉਹਨਾਂ ਬੰਦਿਆਂ ਕਰਕੇ ਹੈ ਨਾ ਵੀ ਪੰਜਾਬ ਦੇ ਹੋਰ ਲੋਕਾਂ ਦੀ ਵੀ ਜਿਹੜੀ ਸੀਗੀ ਹੈ ਨਾ ਵੀ ਜ਼ਮੀਰ ਸੀਗੀ ਉਹ ਜਾਗ ਗਈ ਸੀ ਵੀ ਜਿਹੜੇ ਵੀ ਸਰਕਾਰ ਹੈ ਨਾ ਵੀ ਆਪਣਿਆਂ ਨੂੰ ਧੱਕਾ ਕਰ ਰਹੀ ਹੈਗੀ ਵੀ ਜਿਵੇਂ ਹੁਣ ਇਹ ਬੰਦੇ ਸੀਗੇ ਨਾ ਇਹ ਬਾਹਰ ਰਹਿੰਦੇ ਸੀਗੇ ਹੈ ਤਾਂ ਵੀ ਵੀ ਇੰਗਲੈਂਡ ਰਹਿੰਦੇ ਸੀਗੇ ਇਹ ਅਤੇ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਜਦੋਂ ਦੇਖਿਆ ਵੀ ਪੰਜਾਬ ਦੇ ਵਿੱਚ ਹੈ ਨਾ ਵੀ ਅੰਗਰੇਜ਼ ਵੀ ਇੰਨੇ ਉਹ ਵੀ ਧੱਕਾ ਕਰ ਰਹੇ ਨੇ ਹੈ ਨਾ ਵੀ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਵੀ ਆਜ਼ਾਦ ਕਰਾਉਣਾ ਚਾਹੀਦਾ ਵੀ ਸਰਕਾਰ ਗਲਤ ਕਰ ਰਹੀ ਹੈ ਲੋਕਾਂ ਦੇ ਉੱਤੇ ਤਾਂ ਵੀ ਇਹਨਾਂ ਨੇ ਨਾ ਇੱਕ ਪਲੈਨਿੰਗ ਕੀਤੀ ਸੀਗੀ ਵੀ ਆਪਾਂ ਵੀ ਪੰਜਾਬ ਜਾਂਦੇ ਹਾਂ ਹੈ ਨਾ ਤਾਂ ਫਿਰ ਇਹਨਾਂ ਨੇ ਇੱਕ ਜਹਾਜ਼ ਸੀਗਾ ਵੀ ਆਪਣੇ ਸਿੱਖ ਇਤਿਹਾਸ ਦੇ ਵਿੱਚ ਵੀ ਬਹੁਤ ਜ਼ਿਕਰ ਆਉਂਦਾ ਕਾਮਾਗਾਟਾਮਾਰੂ ਜਹਾਜ਼ ਸੀਗਾ ਨਾ ਵੀ ਉਹ ਜਹਾਜ਼ ਇਹਨਾਂ ਨੇ ਉਹਦੇ ਰਾਹੀਂ ਗਏ ਸੀਗੇ ਇੱਧਰ ਆਏ ਸੀਗੇ ਤਾਂ ਮਤਲਬ ਇੱਧਰ ਆ ਆਉਣ ਤੱਕ ਵੀ ਇਹਨਾਂ ਨੂੰ ਬਹੁਤ ਸਾਰੀਆਂ ਮੁਸ ਮੁਸ਼ਕਿਲਾਂ ਆਈਆ ਵੀ ਇਹਨਾਂ ਨੂੰ ਜਹਾਜ਼ ਉਤਰਨਣੀ ਦਿੱਤਾ ਸੀਗਾ ਹੈ ਨਾ ਕਲਕੱਤੇ ਰੋਕ ਲਿਆ ਪਹਿਲਾਂ ਜਹਾਜ਼ ਇਹਨਾਂ ਦਾ ਪਤਾ ਨਹੀਂ ਕਿੱਥੇ ਕਿੱਥੇ ਮਤਲਬ ਕਿ ਰੋਕਿਆ ਗਿਆ ਨਾ ਵੀ ਇੱਥੇ ਇੰਡੀਆ 'ਚ ਵੜਨ ਹੀ ਨਹੀਂ ਦਿੱਤਾ ਗਿਆ ਉਹਨਾਂ ਨੂੰ ਅਤੇ ਫਿਰ ਇੱਥੇ ਇਹਨਾਂ ਨੇ ਕੀ ਕੀਤਾ ਵੀ ਕਲਕੱਤੇ ਕਿਵੇਂ ਨਾ ਕਿਵੇਂ ਪਹੁੰਚੇ ਤਾਂ ਜਿਹੜੀ ਆਪਣੀ ਅੰਗਰੇਜ਼ ਸਰਕਾਰ ਸੀਗੀ ਇਹਨਾਂ ਨੇ ਕੀ ਉਹਨਾਂ 'ਤੇ ਹਮਲਾ ਬੋਲਤਾ ਮਤਲਬ ਸਿੱਧੀਆਂ ਗੋਲੀਆਂ ਚਲਾ ਕੇ ਉਹਨਾਂ ਨੂੰ ਬੰਦੀ ਬਣਾ ਲਿਆ ਸਿੱਧਾ ਐਵੇਂ ਮਤਲਬ ਉਹਨਾਂ ਦੇ ਅੱਤਿਆਚਾਰ ਢਾਹੇ ਤਾਂ ਫਿਰ ਜਿਹੜੇ ਮਤਲਬ ਕਿ ਆਮ ਲੋਕ ਸੀਗੇ ਨਾ ਵੀ ਉਹਨਾਂ ਨੇ ਵੀ ਦੇਖਿਆ ਨਾ ਵੀ ਇਹ ਬੰਦੇ ਵੀ ਦੇਖ ਲਾ ਐਡੀ ਦੂਰੋਂ ਆਏ ਸੀਗੇ ਹੈ ਨਾ ਵੀ ਪੰਜਾਬ ਨੂੰ ਬਚਾਉਣ ਵਾਸਤੇ ਹੈ ਨਾ ਵੀ ਸਰਕਾਰ ਵੀ ਕਿਵੇਂ ਗਲਤ ਕਰ ਰਹੀ ਹੈ ਇਹਨਾਂ ਨਾਲ ਹੈ ਨਾ ਅਤੇ ਇਹਨਾਂ ਵਿੱਚੋਂ ਹੀ ਆ ਨਾ ਇੱਕ ਕਰਤਾਰ ਸਿੰਘ ਸਰਾਭਾ ਹੈ ਨਾ ਉਹਨਾਂ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਨਾ ਵੀ ਉਹਨਾਂ ਦਾ ਜ਼ਿਕਰ ਵੀ ਬਹੁਤ ਆਉਂਦਾ ਹੈ ਨਾ ਵੀ ਉਹ ਵੀ ਇਹਨਾਂ ਦੇ ਵਿੱਚੋਂ ਹੀ ਸੀ ਇੱਕ ਹੈ ਨਾ ਵੀ ਉਹ ਸਭ ਤੋਂ ਨਾ ਉਹਦੀ ਛੋਟੀ ਉਮਰ ਸੀਗੀ ਹੈ ਨਾ ਉੱਨੀ ਸਾਲ ਦੀ ਉਮਰ ਦੇ ਵਿੱਚ ਹੈ ਨਾ ਉਹਨੂੰ ਫਾਂਸੀ ਦੀ ਸਜ਼ਾ ਹੋਈ ਸੀਗੀ ਅੰਗਰੇਜ਼ਾਂ ਨੇ ਮਤਲਬ ਕਿ ਦੇਖੋ ਉਹਨੂੰ ਫਾਂਸੀ ਸਜ਼ਾ ਦਿੱਤੀ ਸੀਗੀ ਤੁਸੀਂ ਸੋਚ ਸਕਦੇ ਹੋ ਹੈ ਨਾ ਵੀ ਉੱਨੀ ਸਾਲ ਦੀ ਉਮਰ ਕਿੰਨੀ ਛੋਟੀ ਹੁੰਦੀ ਹੈ ਨਾ ਤਾਂ ਫਿਰ ਜਿਹੜੀਆਂ ਆਜ਼ਾਦੀ ਦੀਆਂ ਗੱਲਾਂ ਨੇ ਤਾਂ ਵੀ ਉਹ ਕਿਹੜੀ ਉਮਰ 'ਚ ਮਤਲਬ ਕਿ ਸੋਚਦਾ ਹੋਣਾ ਹੈ ਨਾ ਤਾਂ ਮਤਲਬ ਕਿ ਉਹ ਉਹ ਹੈ ਨਾ ਇਹਨਾਂ ਦੇ ਨਾਲ ਹੀ ਮਤਲਬ ਕਿ ਸੀਗਾ ਜੁੜਿਆ ਹੋਇਆ ਸੀਗਾ ਤਾਂ ਉਹ ਮਤਲਬ ਕਿ ਗਦਰੀ ਬਾਬਿਆ ਦੇ ਕਹਿੰਦੇ ਦੋ ਦਿਨ ਪਹਿਲਾਂ ਪਹੁੰਚ ਗਿਆ ਸੀਗਾ ਉਹ ਤਾਂ ਮਤਲਬ ਕਿ ਇਹ ਜਿਹੜੇ ਗਦਰੀ ਬਾਬੇ ਨੇ ਇਹਨਾਂ ਨੂੰ ਅੱਜ ਤੱਕ ਮਤਲਬ ਕਿ ਸਾਰੇ ਜਾਣਦੇ ਉਹਨਾਂ ਦਾ ਇਤਿਹਾਸ ਵਿੱਚ ਕਿੰਨਾ ਯੋਗਦਾਨ ਆ ਠੀਕ ਹੈ ਇਹਨਾਂ ਕਰਕੇ ਕੀ ਹੈਗਾ ਵੀ ਇਹਨਾਂ ਦਾ ਮਤਲਬ ਜਿਹੜੀ ਆਜ਼ਾਦੀ ਦੇ ਵਿੱਚ ਕੀ ਹੈ ਬਹੁਤ ਵੱਡਾ ਹਿੱਸਾ ਹੈਗਾ ਵੀ ਇਹਨਾਂ ਨੂੰ ਆਪਾਂ ਅੱਖੋਂ ਓਹਲੇ ਨਹੀਂ ਕਰ ਸਕਦੇ